ਹੈਲੋ ਹਾਂਜੀ ਸਰ ਗੁਡ ਆਫਟਰਨੂਨ ਹਾਂ ਕੀ ਤੁਸੀਂ ਹੁਸ਼ਿਆਰਪੁਰ ਤੋਂ ਬੋਲਦੇ ਹੋ ਠੀਕ ਆ ਸਰ ਮੈਂ ਸਰ ਜਰਨਲਿਸਟ ਆ ਮੈਂ ਸੁਣਿਆ ਕਿ ਮਤਲਬ ਕਿ ਮੈਂ ਥੋੜ੍ਹਾ ਹੋਸ਼ਿਆਰਪੁਰ ਦੇ ਬਾਰੇ ਤੁਹਾਨੂੰ ਅੱਜ ਕੁਐਰੀ ਕਰਨੀ ਆ ਹੁਸ਼ਿਆਰਪੁਰ ਦੇ ਪਰਸਨਸ ਬਾਰੇ ਜਿਹੜੇ ਮਤਲਬ ਅੱਜ ਕੱਲ੍ਹ ਜਿਹੜੇ ਆਪਣੇ ਜੋ ਬਈ ਲੋਕ ਆ ਹੁਸ਼ਿਆਰਪੁਰ ਦੇ ਮੈਂ ਸੁਣਿਆ ਦੁਆਬੇ ਵਾਲੇ ਬਹੁਤ ਜ਼ਿਆਦਾ ਬਾਹਰ ਨੂੰ ਜਾ ਰਹੇ ਆ ਇਹਦਾ ਕੀ ਕਾਰਨ ਆ

ਠੀਕ ਤੁਹਾਡੇ ਅਕੋਰਡਿੰਗ ਤੁਹਾਨੂੰ ਕੀ ਲੱਗਦਾ ਮਤਲਬ ਕਿ ਇਹ ਚੀਜ਼ ਤੁਹਾਨੂੰ ਸਹੀ ਲੱਗ ਰਹੀ ਮਤਲਬ ਕਿ ਨੋ ਕਰੰਟ ਦੀ ਕਿ ਹਾਂ ਸਹੀ ਹੈ ਕਿ ਲੋਕ ਬਾਹਰ ਜਾ ਰਹੇ ਉਹਨਾਂ ਨੇ ਜੋਬ ਨਹੀਂ ਮਿਲ ਰਹੀ ਬਟ ਇਹ ਨਹੀਂ ਹੋ ਸਕਦਾ ਕਿ ਮਤਲਬ ਕਿ ਜੇ ਉਹ ਟਰਾਈ ਕਰਨ ਇੱਥੇ ਇੱਥੇ ਬਈ ਕੁਝ ਹਾਸਿਲ ਕਰ ਸਕਦੇ ਆ ਗਵਰਮੈਂਟ ਜੋਬ ਆਂਦ ਆਉਂਦੀਆਂ ਨੇ ਬੇਸ਼ਕ ਕੰਪਟੀਸ਼ਨ ਤੁਹਾਡੇ ਅਕੋਰਡਿੰਗ ਮਤਲਬ ਕੀ ਹੋਣਾ ਚਾਹੀਦਾ ਕਿ ਤੁਹਾਨੂੰ ਲੱਗਦਾ ਕਿ ਇਹ ਚੀਜ਼ ਸਹੀ ਹੈ ਜੀ ਲੋਕ ਸਾਰੇ ਬਾਹਰ ਜਾ ਰਹੇ ਆ ਦੁਆਬੇ ਵਾਲੇ ਆਪਣੇ ਹਾਂਜੀ

ਮਤਲਬ ਕਿ ਹੁਣ ਜਿਵੇਂ ਕਿ ਹੁਣ ਕਰੰਟ ਵੀ ਨਿਊਜ਼ ਆਇਆ ਕਿ ਜਿਹੜੇ ਆਪਣੇ ਡੀਪੋਰਟ ਹੋ ਕੇ ਆਏ ਆ ਪਰਸਨ ਠੀਕ ਆ ਜਿਹੜੇ ਆਪਣੇ ਇੱਕ ਸੋ ਚਾਰ ਪਰਸਨ ਡਿਪੋਰਟ ਹੋ ਕੇ ਆਏ ਆ ਮਤਲਬ ਕਿ ਤੁਹਾਨੂੰ ਨਹੀਂ ਲੱਗਦਾ ਕਿ ਮਤਲਬ ਕਿ ਜਿਹੜੇ ਲੋਕ ਆ ਜੇ ਜਾਣ ਬਾਹਰ ਅਤੇ ਸਹੀ ਤਰੀਕੇ ਨਾਲ ਜਾਣ ਮਤਲਬ ਕੇ ਐਵੇਂ ਡੋਂਕੀਆ ਲਗਾ ਕੇ ਜਾ ਰਹੇ ਆ ਅਤੇ ਉਹ ਚੀਜ਼ ਫਿਰ ਬਾਅਦ 'ਚ ਉਹਨਾਂ ਨੂੰ ਨੁਕਸਾਨ ਦਿੰਦੀ ਹੈ ਅਤੇ ਨਾ ਤਾਂ ਉੱਥੇ ਜੋਬ ਕਰਨ ਜੋਗੇ ਆ ਫਿਰ ਇੰਡੀਆ ਦੇ ਫੇਰ ਉਹਨਾਂ ਨੂੰ ਆਉਣਾ ਹੀ ਪੈ ਰਿਹਾ ਵਾਪਿਸ ਜਦ ਆਪਾਂ ਨੂੰ ਪਤਾ ਹੀ ਹੈ ਕਿ ਮਤਲਬ ਕਿ ਇੰਨੇ ਪੈਸੇ ਲਾ ਕੇ ਵੀ ਸਾਡਾ ਉਥੇ ਕੰਮ ਨਹੀਂ ਬਣਨਾ ਤਾਂ ਇਸ ਤੋਂ ਚੰਗਾ ਅਸੀਂ ਇੱਥੇ ਹੀ ਕੁਝ ਟਰਾਈ ਕਰ ਲਈਏ ਤੁਹਾਡੇ ਅਕੋਰਡਿੰਗ ਕੀ ਮਤਲਬ ਬਈ ਹਾਂਜੀ ਹਾਂਜੀ ਹੋਰ ਤੁਸੀਂ ਕੀ ਮਤਲਬ ਕੀ ਰੀਜਨ ਦੱਸ ਸਕਦੇ ਹੋ ਜਿਵੇਂ ਕਿ ਚਲੋ ਇੱਕ ਤਾਂ ਹੋ ਗਿਆ ਕਿ ਅੱਜ ਕੱਲ੍ਹ ਬਾਹਰ ਅਨਇਮਪਲੋਇਮੈਂਟ ਕਰਕੇ ਲੋਕ ਜਾ ਰਹੇ ਆ ਹੋਰ ਤੁਹਾਡੇ ਅਕੋਰਡਿੰਗਲੀ ਕੀ ਰੀਜ਼ਨ ਹੋ ਸਕਦੇ ਜਿਹਦੇ ਆਪਾਂ ਅਨਪਲਾਈਡ ਤੋਂ ਇਲਾਵਾ ਮੰਨੀਏ ਇੱਕ ਤਾਂ ਚਲੋ ਇਹ ਪੈਸ਼ਨ ਹੋ ਗਿਆ ਲੋਕਾਂ ਨੂੰ ਕਿ ਬਾਹਰ ਹਾਈ ਸਟੈਟਸ ਲੈਣਾ ਇੱਕ ਆਪਣਾ ਹੋ ਗਿਆ ਕਿ ਅਨਇਮਪਲੋਇਮੈਂਟ ਹੋਰ ਤੁਹਾਡੇ ਅਕੋਰਡਿੰਗ ਮਤਲਬ ਕਿ ਤੀਸਰਾ ਰੀਜ਼ਨ ਕੀ ਹੋ ਸਕਦਾ

ਇੱਕ ਕਿਉਂਕਿ ਆਪਣੇ ਹੁਣ ਪੰਜਾਬ 'ਚ ਡਰੱਗ ਅਵਿਊਜ ਵੀ ਬਹੁਤ ਵੱਧ ਰਿਹਾ ਨਾ ਇਸ ਕਰਕੇ ਵੀ ਸ਼ਾਇਦ ਲੋਕ ਆਪਣੇ ਬੱਚਿਆਂ ਨੂੰ ਪ੍ਰੋਟੈਕਟ ਕਰਨ ਲਈ ਮੈਨੂੰ ਲੱਗਦਾ ਕਿ ਥੋੜ੍ਹਾ ਭੇਜ ਰਹੇ ਆ ਕਿ ਸਾਡਾ ਬੱਚਾ ਖ਼ਰਾਬ ਨਾ ਹੋ ਜਾਵੇ ਇਹਤੋਂ ਚੰਗਾ ਇਹਨੂੰ ਬਾਹਰ ਹੀ ਭੇਜ ਦੇਈਏ ਹਾਂਜੀ ਹੋਰ ਕੋਈ ਤੁਸੀਂ ਆਪਣੇ ਅਕੋਡਿੰਗ ਸੁਜਾਸ਼ਨ ਦੱਸੋਗੇ ਮਤਲਬ ਕਿ ਜਿਹੜੇ ਬਾਹਰ ਜਾ ਰਹੇ ਆ ਯੂਥ ਦੇ ਲਈ ਤੁਸੀਂ ਉਹਨਾਂ ਨੇ ਕੀ ਕਹਿਣਾ ਚਾਹੋਗੇ ਮਤਲਬ ਜੇ ਆਪਾਂ ਇੱਕ ਤੌਰ 'ਤੇ ਦੱਸਿਆ ਜਾਵੇ ਕਿ ਹਾਂ ਯੂਥਾਂ ਲਈ ਕੋਈ ਮੈਸੇਜ ਆਪਣੀ ਯੂਥ ਲਈ ਕੋਈ ਮੈਸੇਜ ਦੱਸਿਆ ਜਾਵੇ ਤੁਸੀਂ ਕੀ ਮਤਲਬ ਕਿ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਕੀ ਕਿਸ ਤਰੀਕੇ ਨਾਲ ਜੇ ਉਹ ਜਾਣ ਤਾਂ ਕਿਸ ਤਰੀਕੇ ਨਾਲ ਜਾਣ ਅਤੇ ਨਹੀਂ ਤਾਂ ਫਿਰ ਇੱਥੇ ਕੀ ਉਹ ਕਰ ਸਕਣ ਤੁਸੀਂ ਕੀ ਮਤਲਬ ਕੀ ਤੁਹਾਡੇ ਅਕੋਰਡਿੰਗ ਕੀ ਤੁਸੀਂ ਸੁਜੈਸਟ ਕਰੋਗੇ ਮਤਲਬ ਕਿ ਓਹੀ ਮਤਲਬ ਟੂਰਿਸਟ ਵੀਜ਼ਾ ਜਾਣਾ ਟੂਰਿਸਟ ਦੇ ਨਾ ਜਾਓ ਐਜੂਕੇਸ਼ਨ ਦੇ ਨਾਲ ਐਜਕੇਸ਼ਨ ਨਾਲ ਜਾਣਾ ਵਰਕ ਵੀਜਾ 'ਤੇ ਜਾਣਾ ਵਰਕ ਵੀਜਾ 'ਤੇ ਜਾਓ ਬਟ ਉਹੀ ਕਿ ਮਤਲਬ ਕਿ ਗਲਤ ਰੂਟ ਦੇ ਥਰੂ ਨਹੀਂ ਜਾਣਾ ਚਾਹੀਦਾ ਯੂਥ ਨੂੰ ਇਹੀ ਅਸੀਂ ਅੱਜ ਦੇ ਮਤਲਬ ਕਿ ਮੈਸਜ ਦੇਣਾ ਚਾਹੁੰਦੇ ਆ ਅਤੇ

ਬਿਲਕੁਲ ਬਿਲਕੁਲ ਥੈਂਕ ਯੂ ਸਰ ਤੁਸੀਂ ਸਾਨੂੰ ਟਾਈਮ ਦਿੱਤਾ ਥੈਂਕ ਯੂ